ਸਾਡੇ ਪੰਜਾਬ ਦੇ ਵਿੱਚ ਬਹੁਤ ਹੀ ਮਨਪਸੰਦ ਥਾਵਾਂ ਹਨ ਜਿਵੇਂ ਕਿ ਅੰਮ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਗੋਲਡਨ ਟੈਂਪਲ ਅਤੇ ਜਲ੍ਹਿਆਂਵਾਲਾ ਬ ਬਾਗ ਬਹੁਤ ਹੀ ਮਨਪਸੰਦ ਹੈ ਅਤੇ ਫਤਿਹਗੜ੍ਹ ਸਾਹਿਬ ਵਿੱਚ ਜਿੱਥੇ ਕਿ ਦੋ ਬੱਚੇ ਸ਼ਹੀਦ ਹੋਏ ਹਨ ਉਹ ਵੀ ਬਹੁਤ ਹੀ ਦਰਬਾਰ ਸਾਹਿਬ ਦੇਖਣਯੋਗ ਹੈ ਅਤੇ ਸ਼੍ਰੀ ਚਮਕੌਰ ਸਾਹਿਬ ਵਿਖੇ ਜਿੱਥੇ ਦੋ ਵੱਡੇ ਸਾਹਿਬਜ਼ਾਦੇ ਸ਼ਹੀਦ ਹੋਏ ਹਨ ਉਹ ਵੀ ਬਹੁਤ ਹੀ ਵਧੀਆ ਦੇਖਣਯੋਗ ਹੈ ਅਤੇ ਗੁਰੂਆਂ ਪੀਰਾਂ ਦੀ ਧਰਤੀ ਯਾ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਜਿੱਥੇ ਖਾਲਸਾ ਪੰਥ ਦੀ ਨੀਂਹ ਰੱਖੀ ਗਈ ਸੀ ਉੱਥੇ ਵੀ ਲੋਕ ਬਹੁਤ ਨਮਸਤਕ ਹੁੰਦੇ ਹਨ ਅਤੇ ਬਹੁਤ ਦੇਖਣ ਨੂੰ ਬਹੁਤ ਕੁਛ ਦੇਖਣ ਨੂੰ ਹੈ ਅਤੇ ਸ਼੍ਰੀ ਮਾਛੀਵਾੜਾ ਸਾਹਿਬ ਵਿਖੇ ਵੀ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਆਏ ਸਨ ਉਹ ਵੀ ਗੁਰਦੁਆਰਾ ਸਾਹਿਬ ਬਹੁਤ ਹੀ ਦੇਖਣਯੋਗ ਹੈ